ਮੈਂ ਦਿਕਸ਼ਾ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕਿਵੇਂ ਵੱਖ ਵੱਖ ਨਾ ਨੌਕਰੀਆਂ ਦੇ ਮੌਕੇ ਖੋਲ੍ਹਣ ਵਿੱਚ ਟੈਕਨੋਲਜੀ ਨੇ ਸਾਡੀ ਮਦਦ ਕੀਤੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੱਚੇ ਬਾਰਵੀਂ ਕਸ ਕਰਨ ਤੋਂ ਬਾਅਦ ਕੁਝ ਬੱਚੇ ਜੋ ਹੈ ਬੀ ਏ ਬੀਐਸਸੀ ਜਾਂ ਫਿਰ ਬੀਕੋਮ ਡਿਗਰੀਆਂ ਕਰਦੇ ਹਨ ਅਤੇ ਉਸ ਤੋਂ ਬਾਅਦ ਬੀਐਡ ਕਰਕੇ ਅਧਿਆਪਕ ਦੀ ਨੌਕਰੀ ਕਰਦੇ ਹਨ ਅਤੇ ਕੁਝ ਬੱਚੇ ਆਈ ਟੀ ਆਈ ਦੇ ਵਿੱਚ ਕੋਰਸ ਕਰਕੇ ਜਿਵੇਂ ਕਿ ਫੀਟਰ ਦਾ ਪਲੰਬਰਿੰਗ ਦਾ ਕੰਪਿਊਟਰ ਦਾ ਇਹ ਕੋਰਸ ਕਰਨ ਤੋਂ ਬਾਅਦ ਉਹ ਜੋ ਹੈ ਪੋਲੀਟੈਕਨਿਕ ਲਾਈਨ ਦੇ ਵਿੱਚ ਜਾਣਾ ਪਸੰਦ ਕਰਦੇ ਹਨ ਅਤੇ ਉਸ ਤਰ੍ਹਾਂ ਕੁਝ ਬੱਚੇ ਜੋ ਹੈ ਉਹ ਮੈਡੀਕਲ ਲਾਈਨ ਵਿੱਚ ਜਾਂਦੇ ਹਨ ਜੋ ਐਮ ਬੀ ਬੀ ਐਸ ਕਰਕੇ ਡਾਕਟਰ ਬਣਨਾ ਪਸੰਦ ਕਰਦੇ ਹਨ ਇਸ ਤਰ੍ਹਾਂ ਟੈਕਨੋਲਜੀ ਨੇ ਜੋ ਹੈ ਉਹ ਹਰ ਪਾਸੇ ਵੱਖ ਵੱਖ ਨੌਕਰੀਆਂ ਦੇ ਮੌਕੇ ਸਾਨੂੰ ਦਿੱਤੇ ਹਨ ਅਤੇ ਕੁਝ ਬੱਚੇ ਅੱਗੇ ਹੋਰ ਵਧਕੇ ਵੱਡੇ ਕਾਲਜਾਂ ਵਿੱਚ ਜਾਂਦੇ ਹਨ ਉੱਥੇ ਉਹ ਐਮਫਿਲ ਮਾਸਟਰਸ ਡਿਗਰੀ ਜਾਂ ਫਿਰ ਪੀ ਐਚ ਡੀ ਦੀ ਡਿਗਰੀਆਂ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਆਪਣੇ ਭਵਿੱਖ ਵਿੱਚ ਹੋਰ ਵੀ ਵਧੀਆ ਜੋ ਹੈ ਨੌਕਰੀਆਂ ਮਿਲਦੀਆਂ ਹਨ ਅਤੇ ਉਹ ਟੈਕਨੋਲੋਜੀ ਦੀ ਵਰਤੋਂ ਕਰਕੇ ਉਹਨਾਂ ਨੌਕਰੀਆਂ ਨੂੰ ਹੋਰ ਅੱਗੇ ਵਧਾਉਣ ਵਿੱਚ ਸਕਸ਼ਮ ਹੁੰਦੇ ਹਨ ਅਤੇ ਉਹ ਆਪਣੀਆਂ ਡਿਗਰੀਆਂ ਜੋ ਹੈ ਉਹ ਉਸ ਡਿਗਰੀਆਂ ਦੇ ਰਾਹੀ ਹੀ ਆਪਣੇ ਨੌਕਰੀ ਨੂੰ ਅੱਗੇ ਜਾਰੀ ਰੱਖਣਾ ਪਸੰਦ ਕਰਦੇ ਹਨ ਅਤੇ ਅੱਜ ਕੱਲ੍ਹ ਦੇ ਜੋ ਵਿਦਿਆਰਥੀ ਹਨ ਉਹ ਆਪਣੇ ਡਿਗਰੀਆਂ ਨੂੰ ਉਸ ਤਰੀਕੇ ਨਾਲ ਕਰਦੇ ਹਨ ਉਹਨਾਂ ਨੇ ਅੱਗੇ ਆਪਣੇ ਭਵਿੱਖ ਵਿੱਚ ਜੋ ਬਣਨਾ ਹੁੰਦਾ ਹੈ ਧੰਨਵਾਦ